ਮੈਂ ਰਨਿੰਗ ਤਾਂ ਨਹੀਂ ਕਰਦੀ ਬਟ ਮੈਂ ਸਵੇਰੇ ਸੈਰ ਕਰਨ ਜਾਂਦੀ ਹਾਂ ਅਤੇ ਜਦੋਂ ਸਵੇਰੇ ਸੈਰ ਕਰਨ ਜਾਂਦੇ ਹਾਂ ਤਾਂ ਉਸ ਟਾਈਮ ਜਿਹੜੇ ਸਾਡੇ ਪੌਦੇ ਹੁੰਦੇ ਆ ਉਹ ਸਾਨੂੰ ਆਕਸੀਜਨ ਦਿੰਦੇ ਆ ਅਤੇ ਸੂਰਜ ਹੁੰਦਾ ਅਤੇ ਉਹ ਸਾਨੂੰ ਵਿਟਾਮਿਨ ਡੀ ਦਿੰਦਾ ਅਤੇ ਉਸ ਦੇ ਨਾਲ਼ ਜਿਹੜਾ ਸਾਡਾ ਸਰੀਰ ਆ ਉਹ ਤੰਦਰੁਸਤ ਰਹਿੰਦਾ ਅਤੇ ਜਿਹੜਾ ਦਿਨ ਆ ਉਹ ਵੀ ਬਹੁਤ ਵਧੀਆ ਲੰਘਦਾ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਵੋਕ ਕਰਨ ਜਾਂਦੇ ਹਾਂ ਅਤੇ ਉਦੋਂ ਅਸੀਂ ਘਾਹ 'ਤੇ ਜਿਹੜੀ ਥੋੜ੍ਹੀ ਬਹੁਤ ਆ ਅਸੀਂ ਉਹ ਵੋਕ ਕਰਦੇ ਹੁੰਦੇ ਹਾਂ